ਮੇਰਾ ਪਿੰਡ ਇੱਕ ਖੁੱਲ੍ਹੇ ਡੁੱਲੇ ਮਾਹੌਲ ਦੇ ਵਿੱਚ ਸਥਿਤ ਹੈ ਇਹੋ ਜਿਹਾ ਖੁੱਲ੍ਹਾ ਡੁੱਲਾ ਮਾਹੌਲ ਕਿ ਜਿੱਥੋਂ ਦੀਆਂ ਗਲੀਆਂ ਤਾਂ ਭੀੜੀਆਂ ਨੇ ਪਰ ਵਿਹੜੇ ਬਹੁਤ ਖੁੱਲ੍ਹੇ ਨੇ ਇਹਨਾਂ ਵਿਹੜਿਆਂ ਦੇ ਵਿੱਚ ਅਸੀਂ ਖੇਡਣਾ ਮੱਲਣਾ ਖੁਸ਼ੀਆਂ ਮਾਨਣੀਆਂ ਅਤੇ ਹੋਰ ਵੀ ਕਈ ਤਰ੍ਹਾਂ ਦੇ ਤਿਉਹਾਰ ਮਨਾਉਣੇ ਮੈਨੂੰ ਮੇਰਾ ਪਿੰਡ ਬਹੁਤ ਹੀ ਜ਼ਿਆਦਾ ਪਸੰਦ ਹੈ ਕਿਉਂਕਿ ਇੱਥੇ ਮੇਰਾ ਬਚਪਨ ਬੀਤਿਆ ਬਚਪਨ ਤੋਂ ਹੁੰਦਿਆਂ ਹੋਇਆਂ ਜਵਾਨੀ ਵਿੱਚ ਆਏ ਹਾਂ ਬਚਪਨ ਦੇ ਵਿੱਚ ਅਸੀਂ ਆਪਣੇ ਸੰਗੀ ਸਾਥੀਆਂ ਦੇ ਨਾਲ ਗਲੀਆਂ ਦੇ ਵਿੱਚ ਘੁੰਮਦੇ ਰਹਿਣਾ ਖੇਡਦੇ ਰਹਿਣਾ ਸਕੂਲੇ ਪੜ੍ਹਨ ਜਾਣਾ ਅਤੇ ਫੇਰ ਸਕੂਲੋਂ ਆ ਕੇ ਸਭਨਾਂ ਨੇ ਖੇਡਾਂ ਖੇਡਣੀਆਂ ਕਈ ਤਰ੍ਹਾਂ ਦੀਆਂ ਖੇਡੀਆਂ ਖੇਡਾਂ ਖੇਡਣੀਆਂ ਜਿਵੇਂ ਕਿ ਗੁੱਲੀ ਡੰਡਾ ਬਾਂਟੇ ਅਤੇ ਹੋਰ ਵੀ ਕਈ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਪਿੰਡਾਂ ਦੇ ਲੋਕਾਂ ਨੇ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਨਾਲ ਖੜ੍ਹੇ ਹੋ ਜਾਣਾ ਜੇ ਕਿਸੇ ਨੂੰ ਕਿਸੇ ਦੀ ਮਦਦ ਹੋਣੀ ਤਾਂ ਸਭ ਨੇ ਆਉਣ ਖਲੋ ਜਾਣਾ ਪਿੰਡਾਂ ਦੇ ਮਾਹੌਲ ਦੀ ਗੱਲ ਹੀ ਕੀ ਕਰੀਏ ਮੌਸਮ ਬਹੁਤ ਹੀ ਜ਼ਿਆਦਾ ਸੁਹਾਵਣਾ ਹੁੰਦਾ ਹੈ ਆਲੇ ਦੁਆਲੇ ਪੈਲੀਆਂ 'ਤੇ ਰੁੱਖਾਂ ਦੇ ਹੋਣ ਕਰਕੇ ਪਿੰਡਾਂ ਦਾ ਜਿਹੜੀ ਹਵਾ ਹੁੰਦੀ ਹੈ ਉਹ ਵੀ ਪ੍ਰਦੂਸ਼ਣ ਰਹਿਤ ਹੁੰਦੀ ਹੈ ਕੋਈ ਵੀ ਚਿੜੀਆਂ ਦੀਆਂ ਆਵਾਜ਼ਾਂ ਸੁਣਦਾ ਆ ਅਤੇ ਉਦਾਸੀ ਤੋਂ ਦੂਰ ਹੋ ਕੇ ਉਸਨੂੰ ਸਕੂਨ ਮਿਲਦਾ ਹੈ ਮੈਂ ਜਦੋਂ ਵੀ ਉਦਾਸ ਹੋਵਾਂ ਤਾਂ ਮੈਂ ਜਾ ਕੇ ਆਪਣੇ ਖੇਤਾਂ ਦੇ ਵਿੱਚ ਬਹਿ ਜਾਂਦੀ ਹਾਂ ਤਾਂ ਜੋ ਉੱਥੋਂ ਦੀ ਉੱਥੋਂ ਦੀ ਜਿਹੜੀ ਤਾਜ਼ੀ ਹਵਾ ਮੈਨੂੰ ਬਿਲਕੁਲ ਹੀ ਸਕੂਨ ਦੇ ਦਿੰਦੀ ਹੈ ਸਾਰਿਆਂ ਨੇ ਰਲ ਮਿਲ ਕੇ ਖੇਡਾਂ ਖੇਡਣੀਆਂ ਅਤੇ ਜਦੋਂ ਵੀ ਕੋਈ ਜਦੋਂ ਮੇਲਾ ਲੱਗਦਾ ਤਾਂ ਸਭ ਆ ਕੇ ਇਕੱਠੇ ਹੋ ਕੇ ਮੇਲਿਆਂ ਦੇ ਵਿੱਚ ਜਾਂਦੇ ਇਹਨਾਂ ਮੇਲਿਆਂ ਦੀਆਂ ਲਲਕਾਰਾਂ ਦੂਰ ਤੱਕ ਸੁਣਦੀਆਂ ਸਨ ਪਿੰਡਾਂ ਦੇ ਮੇਲਿਆਂ ਦੀ ਚਮਕਾਰਾਂ ਦੂਰ ਤੱਕ ਦਿੱਖਦੀਆਂ ਸਨ ਸੋ ਪਿੰਡਾਂ ਦੇ ਨਜ਼ਾਰੇ ਕਿਤੇ ਵੀ ਨਹੀਂ ਲੱਭਦੇ ਹੁੰਦੇ ਕਿਉਂਕਿ ਪਿੰਡਾਂ ਦੇ ਵਿੱਚ ਸ਼ੋਰ ਸ਼ਰਾਬਾ ਨਹੀਂ ਹੁੰਦਾ ਪਿੰਡਾਂ ਦੇ ਵਿੱਚ ਜੋ ਆਵਾਜ਼ਾਂ ਸੁਣਦੀਆਂ ਨੇ ਪੰਛੀਆਂ ਦੇ ਗੀਤ ਸੁਣਦੇ ਨੇ ਉਹ ਇੱਕ ਸਕੂਨ ਦਿੰਦੇ ਨੇ